ਪੰਜਾਬ ਭਾਰਤ ਦਾ ਇੱਕ ਵਿਕਸਿਤ ਪ੍ਰਦੇਸ਼ ਹੈ ਇੱਥੇ ਅਲੱਗ ਅਲੱਗ ਤਰ੍ਹਾਂ ਦੇ ਲੋਕ ਵੱਸਦੇ ਹਨ ਜਿਨ੍ਹਾਂ ਦੇ ਆਪਣੇ ਵੱਖ ਵੱਖ ਰੀਤੀ ਰਿਵਾਜ਼ ਤਿਉਹਾਰ ਕਲਾਵਾਂ ਅਤੇ ਜੀਵਨ ਸ਼ੈਲੀਆਂ ਹਨ ਜਿਨਾਂ ਨੂੰ ਉਹ ਆਪਣੇ ਆਪਣੇ ਤਰੀਕੇ ਨਾਲ਼ ਦਰਸਾਉਂਦੇ ਹਨ ਉਹ ਇਹ ਆਪਣੇ ਤਿਉਹਾਰਾਂ ਉੱਤੇ ਸਮਾਗਮਾਂ ਉੱਤੇ ਪ੍ਰਦਰਸ਼ਨ ਕਰਦੇ ਹਨ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਗਿੱਧਾ ਭੰਗੜਾ ਬੋਲੀਆਂ ਦਾ ਪ੍ਰਚਲਣ ਹੈ ਅਤੇ ਇਹ ਬਹੁਤ ਹੀ ਮਨੋਰੰਜਕ ਅਤੇ ਆਸਾਨੀ ਨਾਲ਼ ਖੁਸ਼ੀਆਂ ਦੇ ਮੌਕਿਆਂ ਉੱਤੇ ਕੀਤਾ ਜਾ ਸਕਦਾ ਹੈ ਇਸ ਨਾਲ਼ ਸਰੀਰਕ ਅਤੇ ਮਾਨਸਿਕ ਤੌਰ 'ਤੇ ਇਨਸਾਨ ਖੁਸ਼ ਅਤੇ ਤੰਦਰੁਸਤ ਰਹਿੰਦਾ ਹੈ ਇਸਦਾ ਰਵਾਇਤੀ ਪਹਿਰਾਵਾ ਅਤੇ ਤਰੀਕਾ ਬਹੁਤ ਹੀ ਦਿਲ ਛੂਹ ਲੈਣ ਵਾਲਾ ਹੁੰਦਾ ਹੈ